ਪੰਜਾਬ ਵਿੱਚ ਵਧ ਰਹੇ ਹਾਦਸੇ ਅਤੇ ਬੁਰੇ ਹਾਲਾਤਾਂ ਨੂੰ ਨਜ਼ਰ ਵਿੱਚ ਰੱਖਦੇ ਹੋਏ ਰਾਜਨੀਤਿਕ ਹੁਣ ਜਗ੍ਹਾ ਹਰ ਜਗ੍ਹਾ ਯੋਗਦਾਨ ਦੇ ਰਹੇ ਇਸ ਵਿੱਚ ਵੱਧ ਤੋਂ ਵੱਧ ਸੁਰੱਖਿਆ ਅਤੇ ਪ੍ਰਬੰਧ ਲਗਾਏ ਜਾ ਰਹੇ ਹਨ ਸਿਕਿਉਰਟੀਆਂ ਵਧਾਈਆਂ ਜਾ ਰਹੀਆਂ ਹਨ ਆਪਣੇ ਰਾਜ ਨੂੰ ਸੁਰੱਖਿਆ ਰੱਖਣ ਲਈ ਪੁਲਿਸ ਦੀ ਸਕਿਉਰਟੀ ਵੱਧ ਤੋਂ ਵੱਧ ਲਗਾਈ ਜਾ ਰਹੀ ਹੈ ਤਾਂ ਕਿ ਕੋਈ ਘਟਨਾ ਵਾਪਰਨ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਜਾਵੇ ਕਈ ਰਾਜਾਂ ਵਿੱਚ ਨਸ਼ੇ ਕਾਰਨ ਕਈ ਯੰਗ ਯੂਥ ਇਸ ਦਾ ਸ਼ਿਕਾਰ ਹੋਏ ਹਨ ਜਿਹਨਾਂ ਨੂੰ ਰੋਕਣ ਲਈ ਕਈ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਹਨ ਸਾਡੇ ਰਾਜ ਵਿੱਚ ਪੁਲਿਸ ਨੂੰ ਪਿੱਛੋਂ ਜਦੋਂ ਇਸ਼ਾਰਾ ਮਿਲਦਾ ਹੈ ਕਿ ਕਿਸੇ ਜਗ੍ਹਾ 'ਤੇ ਘਟਨਾ ਵਾਪਰਨ ਵਾਲੀ ਹੈ ਤਾਂ ਪੁਲਿਸ ਉਸ ਦਾ ਵੇਰਵਾ ਲੈਣ ਲਈ ਪਹੁੰਚ ਜਾਂਦੀ ਹੈ ਸਾਡੇ ਹਰ ਰਾਜ ਦੇ ਬਾਰਡਰਾਂ 'ਤੇ ਫੌਜਾਂ ਤਾਣ ਕੇ ਬੰਦੂਕਾਂ ਬੋਰਡਰ ਦੀ ਰੱਖਿਆ ਕਰ ਰਹੀ ਹੈ ਤਾਂ ਕਿ ਕੋਈ ਦੁਸ਼ਮਣ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕਣ ਅਗਰ ਘਟਨਾ ਵਾਪਰਨ ਵੀ ਵਾਪਰੀ ਵੀ ਜਾਵੇ ਤਾਂ ਸਾਡੇ ਰਾਜਾਂ ਦੀ ਪੁਲਿਸ ਉਸ ਘਟਨਾ ਦਾ ਸਥਾਨ 'ਤੇ ਵੇਰਵਾ ਕਰਕੇ ਖੁਫੀਆ ਏਜੰਸੀਆਂ ਰਾਹੀਂ ਪਤਾ ਕਰਵਾ ਲੈਂਦੀ ਹੈ ਤਾਂ ਕਿ ਇਸ ਦੇ ਅਪਰਾਧੀ ਨੂੰ ਸਜ਼ਾ ਦਿੱਤੀ ਜਾਵੇ